ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਸਕੀਮਾਂ ਨੇ ਉਹ ਚਲਾਈਆ ਨੇ ਜੇ ਤਾਂ ਮੈਂ ਸ ਸਿਹਤ ਵਿਭਾਗ ਤੋਂ ਸਿਹਤ ਵਿਭਾਗ ਦੀ ਗੱਲ ਕਰਾਂ ਤਾਂ ਇਹਨਾਂ ਨੇ ਇੱਕ ਆਮ ਆਦਮੀ ਕਲੀਨਿਕ ਖੋਲ੍ਹੇ ਹੋਏ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਹੈ ਨਾ ਅਲੱਗ ਅਲੱਗ ਕਸਬਿਆਂ ਦੇ ਵਿੱਚ ਜਿੱਥੇ ਕਿ ਇੱਕ ਆਮ ਬੰਦਾ ਆ ਨਾ ਫਰੀ ਚੈਕਅੱਪ ਕਰਵਾ ਸਕਦਾ ਉਹਨੂੰ ਫਰੀ ਦਵਾਈ ਮਿਲਦੀ ਹੈਗੀ ਅਤੇ ਜੇ ਸਿਖਿਆ ਖੇਤਰ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਕੀ ਆ ਇਹਨਾਂ ਨੇ ਵੱਡੀ ਤਬਦੀਲੀ ਕੀ ਕੀਤੀ ਹੈਗੀ ਵੀ ਜਿਹੜੇ ਆਪਣੇ ਜਿਹੜੇ ਸਰਕਾਰੀ ਸਕੂਲ ਹੁੰਦੇ ਆ ਨਾ ਵੀ ਇਹਨਾਂ ਨੇ ਇਹਨੂੰ ਹੀ ਤਬਦੀਲ ਕਰਤਾ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਉਹਨੂੰ ਵਧੀਆ ਹੈ ਨਾ ਵੀ ਜਿਵੇਂ ਆਪਣੇ ਪੁਰਾਣੇ ਕੀ ਸੀਗਾ ਪੁਰਾਣੇ ਟਾਈਮ ਦੇ ਵਿੱਚ ਬੱਚਿਆਂ ਨੂੰ ਨਾ ਹੀ ਪੜ੍ਹਾਇਆ ਜਾਂਦਾ ਸੀਗਾ ਜਿਵੇਂ ਬਸ ਹੈ ਨਾ ਜਿਵੇਂ ਬੋਲ ਬੋਲ ਕੇ ਪੜ੍ਹਾਇਆ ਜਾਂਦਾ ਸੀ ਲਿਖ ਕੇ ਹੈ ਨਾ ਵੀ ਹੁਣ ਇਹ ਇਹਨਾਂ ਨੇ ਕੀ ਹੈ ਵੀ ਜਿਵੇਂ ਨਵੀਂ ਤਕਨੋਲਜੀ ਰਾਹੀਂ ਬੱਚਿਆਂ ਨੂੰ ਨਵੀਂਆਂ ਤਕਨੀਕਾਂ ਰਾਹੀਂ ਇਹਨਾਂ ਨੇ ਮਤਲਬ ਪੜ੍ਹਾਉਣਾ ਸ਼ੁਰੂ ਕਰਤਾ ਅਤੇ ਇੱਕ ਪੰਜਾਬ ਸਰਕਾਰ ਨੇ ਕੀ ਕੀਤਾ ਹੋਇਆ ਵੀ ਆਪਾਂ ਨੂੰ ਇੱਕ ਆਹ ਬਿਜਲੀ ਵਾਲਾ ਮਤਲਬ ਇਹ ਤਿੰਨ ਸੌ ਜਿਹੜੇ ਯੂਨਿਟ ਹੈਗੀ ਮੁਆਫ ਕੀਤੀ ਹੋਈ ਹੈ ਜੇ ਆਪਾਂ ਨੂੰ ਤਿੰਨ ਸੌ ਯੂਨਿਟ ਤੱਕ ਆਪਾਂ ਮਚਾਉਂਦੇ ਹਾਂ ਬਿਜਲੀ ਤਾਂ ਆਪਾਂ ਨੂੰ ਕੋਈ ਬਿੱਲ ਨਹੀਂ ਆਉਂਦਾ ਹੈਗਾ ਤਾਂ ਇਸ ਤੋਂ ਬਗੈਰ ਇਹਨਾਂ ਨੇ ਜਿਵੇਂ ਜਿਵੇਂ ਔਰਤਾਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਸਕੀਮਾਂ ਕਰੀਆਂ ਨੇ ਹੈ ਨਾ ਜਿਵੇਂ ਜਿਵੇਂ ਭਰੂਣ ਹੱਤਿਆ ਰੋਕਣ ਵਾਸਤੇ ਹੋ ਗਿਆ ਸ਼ਗਨ ਸਕੀਮ ਹੋ ਗਈਆਂ ਹੈ ਨਾ ਵੀ ਜਿਹੜੇ ਜ ਜਿਹੜੇ ਲੋਕ ਮਤਲਬ ਕੁੜੀਆਂ ਦੇ ਵਿਆਹ ਨਹੀਂ ਕਰ ਸਕਦੇ ਹੈ ਨਾ ਸਰਕਾਰ ਕੀ ਆ ਉਹਨਾਂ ਨੂੰ ਫੰਡ ਦਿੰਦੀ ਹੈਗੀ ਹੈ ਨਾ ਵੀ ਤਾਂ ਕਿ ਉਹਨਾਂ ਦਾ ਵੀ ਵਿਆਹ ਹੋ ਸਕੇ ਹੈ ਨਾ ਤਾਂ ਇਸ ਤਰ੍ਹਾਂ ਮਤਲਬ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਚਲਾਈਆਂ ਹੋਈਆਂ ਨੇ